ਜਿੱਥੇ ਤੱਕ ਕਿਸਾਨ ਦੀ ਗੱਲ ਕਰੀਏ ਕਿਸਾਨਾਂ ਦੀ ਕਿਸਾਨ ਹੀ ਸਾਡੇ ਦੇਸ਼ ਦਾ ਅੰਨਦਾਤਾ ਹੈ ਇਹਨਾਂ ਨੂੰ ਇ ਇਹ ਨਹੀਂ ਕ ਕੁਛ ਕਰਨਗੇ ਤਾਂ ਅਸੀਂ ਰੋਟੀ ਇਹਨਾਂ ਦੇ ਸਿਰ 'ਤੇ ਖਾਂਦੇ ਹਾਂ ਇਹਨਾਂ ਨੂੰ ਮਤਲਬ ਕਿ ਜਿਸ ਤਰ੍ਹਾਂ ਇਹ ਫ਼ਸਲ ਦਾ ਇਸ ਤਰ੍ਹਾਂ ਕਿ ਇਹਨਾਂ ਨੂੰ ਇਹਨਾਂ ਦੀ ਖੁਦਕੁਸ਼ੀ ਦਾ ਕਾਰਨ ਇਹੀ ਹੁੰਦਾ ਹੈ ਕਿ ਇਹ ਜ਼ਿਆਦਾਤਰ ਕੀ ਕਰਦੇ ਆ ਕਿ ਆਪਣੇ ਲੋਨ ਲੈ ਲੈਂਦੇ ਆ ਲੋਨ ਤੋਂ ਲੋਨ ਲੈ ਕੇ ਕਿਸੇ ਵੇਲੇ ਇਹਨਾਂ ਦੀ ਫ਼ਸਲ ਮੰਨ ਲਓ ਕਿ ਖ਼ਰਾਬ ਹੋ ਜਾਂਦੀ ਹੈ ਜਿਹਦੇ ਪਿੱਛੇ ਉਹਨਾਂ ਨੂੰ ਆਪਣੀ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਉਹਦੇ ਵਿੱਚ ਪੂਰੇ ਪੈਸੇ ਨਹੀਂ ਮਿਲਦੇ ਪੈਸੇ ਨਾ ਪੈਸੇ ਨਾ ਮਿਲਣ ਕਰਕੇ ਇਹ ਆਪਣਾ ਕਰਜ਼ਾ ਨਹੀਂ ਚੁਕਾ ਪਾਉਂਦੇ ਕਰਜ਼ਾ ਜਿਸ ਕਰਕੇ ਇਹ ਖੁਦਕੁਸ਼ੀ ਵੱਲ ਚਲੇ ਜਾਂਦੇ ਆ ਇਹਨਾਂ ਨੂੰ ਖੁਦਕੁਸ਼ੀ ਤੋਂ ਬਚਣਾ ਚਾਹੀਦਾ ਇਹਦੇ ਵਾਸਤੇ ਇਹਨਾਂ ਨੂੰ ਚਾਹੀਦਾ ਕਿ ਜਦੋਂ ਫ਼ਸਲ ਜਿਹੜੀ ਆਪਣੀ ਤਿਆਰ ਕਰਨੀ ਆ ਵਧੀਆ ਤੋਂ ਵਧੀਆ ਉਹ 'ਚ ਬੀਜ ਤਿਆਰ ਬੀਜ ਲਗਾਉਣ ਉਹਦੇ ਵਿੱਚ ਉਹਨਾਂ ਦੇ ਟਾਈਮ ਟੂ ਟਾਈਮ ਦੇਖਭਾਲ ਕਰਨੀ ਚਾਹੀਦੀ ਆ ਉਹਨਾਂ ਨੂੰ ਮਤਲਬ ਕਿ ਜਿਹੜੀ ਜਿਹੜੀ ਕੋਈ ਖਾਦਾਂ ਵਗੈਰਾ ਚਾਹੀਦੀਆਂ ਉਹਨਾਂ ਨੂੰ ਉਸ ਤਰ੍ਹਾਂ ਉਹ ਉਹਨਾਂ ਨੂੰ ਪੌਦਿਆਂ ਨੂੰ ਦੇਣਾ ਚਾਹੀ ਦੇਣੀ ਚਾਹੀਦੀ ਓਵਰ ਕਿਸੇ ਵਾਟਰਿੰਗ ਵੇਲੇ ਜਿਸ ਵੇਲੇ ਜ਼ਿਆਦਾ ਪਾਣੀ ਲਗਾਉਣ ਨਾਲ਼ ਵੀ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਅਤੇ ਬਾਕੀ ਜਿੱਥੇ ਤੱਕ ਗੱਲ ਕਰੀਏ ਕਿ ਇਹਨਾਂ ਦੇ ਲੋਨ ਦੀ ਇਹਨਾਂ ਨੂੰ ਲੋਨ ਵਗੈਰਾ ਜਿਹੜੇ ਜ਼ਿਮੀਂਦਾਰ ਵਗੈਰਾ ਸ਼ਾਹੂਕਾਰ ਇਹਨਾਂ ਕੋਲ ਲੋਨ ਨਹੀਂ ਲੈਣਾ ਚਾਹੀਦਾ ਕਿਉਂਕਿ ਇਹਨਾਂ ਕੋਲ ਲੋਨ ਲੈ ਕੇ ਜਦੋਂ ਇਨ੍ਹਾਂ ਕੋਲੋਂ ਚੁਕਾਇਆ ਨਹੀਂ ਜਾਂਦਾ ਉਹ ਫਿਰ ਤਰ੍ਹਾਂ ਤਰ੍ਹਾਂ ਦੇ ਇਹਨਾਂ ਨੂੰ ਹੈਰਾਸਮੈਂਟ ਕਰਦੇ ਆ ਇਹਨਾਂ ਨੂੰ ਚਾਹੀਦਾ ਕਿ ਜਿਹੜੀ ਸਰਕਾਰ ਨੇ ਮੁਹਿੰਮ ਚਲਾਏ ਹੋਏ ਆ ਉਹਦੇ ਉਹਦੇ ਥਰੂ ਇਹਨਾਂ ਨੂੰ ਲੋਨ ਲੈਣਾ ਚਾਹੀਦਾ ਕਿਉਂਕਿ ਸਰਕਾਰ ਕਿਸੇ ਵੇਲੇ ਕੀ ਕਰਦੀ ਹੈ ਕਿ ਇਹਨਾਂ ਦੇ ਲੋਨ ਮਾਫ਼ ਵੀ ਕਰ ਦਿੰਦੀ ਆ ਇਸ ਪਿੱਛੇ ਇਹਨਾਂ ਨੂੰ ਜ਼ਿਮੀਂਦਾਰਾਂ ਕੋਲ ਕਦੇ ਵੀ ਨਹੀਂ ਲੈਣਾ ਚਾਹੀਦਾ ਲੋਨ ਬਾਕੀ ਜਿੱਥੇ ਤੱਕ ਸਰਕਾਰ ਦੀ ਗੱਲ ਕਰੀਏ ਸਰਕਾਰ ਨੂੰ ਚਾਹੀਦਾ ਕਿ ਇਸ ਕਿਸਾਨਾਂ ਦੀ ਇਹੋ ਜਿਹੀ ਹਾਲਤ ਨੂੰ ਦੇਖ ਕੇ ਕਿਸਾਨ ਇਹੋ ਹੋਰ ਮੁਹਿੰਮ ਚਲਾਉਣੇ ਚਾਹੀਦੇ ਆ ਤਾਂ ਕਿ ਕਿਸਾਨ ਕਿਸਾਨਾਂ ਨੂੰ ਮਤਲਬ ਕਿਸਾਨ ਖ਼ੁਦਕੁਸ਼ੀਆਂ ਵੱਲ ਦੇ ਰਸਤੇ 'ਤੇ ਨਾ ਜਾਣ